ਮਨੁੱਖ ਹਮੇਸ਼ਾਂ ਆਪਣੀਆਂ ਜੜ੍ਹਾਂ ਨਾਲ ਜੁੜਿਆ ਰਹਿਣਾ ਚਾਹੁੰਦਾ ਹੈ ਇਹ ਗੱਲ ਸਹੀ ਹੈ ਸਾਰੇ ਮਨੁੱਖ ਅਸੀਂ ਵੀ ਹੁਣ ਪੰਜਾਬ ਵਿੱਚ ਰਹਿੰਦੇ ਹੋਏ ਅਸੀਂ ਆਪਣੇ ਵਿਰਸੇ ਦੇ ਨਾਲ ਜੁੜੇ ਹੋਏ ਹਾਂ ਅਸੀਂ ਅੱਜ ਵੀ ਪਿੰਡਾਂ ਵਿੱਚ ਰਹਿਣ ਸਹਿਣ ਨੂੰ ਪਸੰਦ ਕਰਦੇ ਹਾਂ ਉੱਥੋਂ ਦੇ ਖਾਣ ਪੀਣ ਨੂੰ ਪਸੰਦ ਕਰਦੇ ਹਾਂ ਜੋ ਵੀ ਰੀਤੀ ਰਿਵਾਜ ਸਾਡੇ ਪੁਰਾਤਨ ਚੱਲ ਰਹੇ ਨੇ ਉਹਨਾਂ ਦੇ ਨਾਲ ਅਸੀਂ ਅੱਜ ਵੀ ਜੁੜੇ ਹੋਏ ਹਾਂ ਜੋ ਵੀ ਖਾਣ ਪੀਣ ਦਾ ਸਾਡਾ ਢੰਗ ਹੈ ਜੋ ਵੀ ਸਾਡਾ ਪਹਿਰਾਵਾ ਹੈ ਉਸ ਦੇ ਨਾਲ ਅਸੀਂ ਅੱਜ ਵੀ ਜੁੜੇ ਹੋਏ ਹਾਂ ਸਾਡੇ ਸਿੱਖ ਧਰਮ ਦੇ ਨਾਲ ਅਸੀਂ ਪਿੰਡਾਂ ਵਿੱਚ ਰਹਿ ਕੇ ਜੁੜੇ ਹੋਏ ਹਾਂ ਪਿੰਡਾਂ ਦੇ ਵਿੱਚ ਅੱਜ ਵੀ ਸਿੱਖ ਧਰਮ ਦੀ ਚਲਾਈ ਹੋਈ ਪਰੰਪਰਾ ਲੰਗਰ ਪ੍ਰਥਾ ਦੇ ਨਾਲ ਜੁੜੇ ਹੋਏ ਹਾਂ ਸਾ ਜਿਸ ਦੇ ਵਿੱਚ ਕੇ ਸਿੱਖ ਧਰਮ ਦੇ ਵਿੱਚ ਜਿੱਦਾਂ ਦੱਸਿਆ ਜਾਂਦਾ ਹੈ ਬਈ ਸੇ ਹਰ ਇੱਕ ਇਨਸਾਨ ਦੀ ਮਦਦ ਕਰਨੀ ਉਹਦੇ ਲਈ ਵੀ ਅਸੀਂ ਹਮੇਸ਼ਾਂ ਤਿਆਰ ਰਹਿੰਦੇ ਹਾਂ ਇਸ ਤਰ੍ਹਾਂ ਅਸੀਂ ਆਪਣੇ ਹਮੇਸ਼ਾਂ ਹੀ ਆਪਣੀਆਂ ਜੜ੍ਹਾਂ ਦੇ ਨਾਲ ਜੁੜੇ ਹੋਏ ਹਾਂ